ਅੰਮ੍ਰਿਤਸਰ ਦੇ ਵਿੱਚ ਜਿਹੜੇ ਸਮਾਜ ਭਲਾਈ ਦੇ ਸਕੂਲਾਂ ਦਾ ਜਿਹੜਾ ਵੱਲ ਧਿਆਨ ਦਿੱਤਾ ਗਿਆ ਹੈ ਹੁਣ ਸਕੂਲਾਂ ਦੀ ਜਿਹੜੇ ਹਾਲਤ ਅੱਗੇ ਨਾਲੋਂ ਚੰਗੀ ਕਰ ਦਿੱਤੀ ਗਈ ਆ ਵਿੱਦਿਆ ਦਾ ਕਿਉਂਕਿ ਸਕੂਲਾਂ ਦੇ ਵਿੱਚ ਮੇਨ ਹੈ ਜਿਹੜਾ ਮੁੱਖ ਕੰਮ ਬੱਚਿਆਂ ਨੂੰ ਪੜ੍ਹਾਉਣਾ ਜਿਹੜਾ ਬਹੁਤ ਮੁੱਖ ਪ੍ਰਮੁੱਖ ਕੰਮ ਹੈਗਾ ਅਤੇ ਜੋ ਸਰਕਾਰ ਨੇ ਸਕੂਲਾਂ ਦੇ ਉੱਤੇ ਕਾਫੀ ਪੈਸਾ ਖਰਚ ਕੀਤਾ ਹੈ ਅਤੇ ਸਕੂਲਾਂ ਦੀ ਹਲ ਹਾਲਤ ਵਧੀਆ ਕੀਤੀ ਹੈ ਟੀਚਰਾਂ ਦਾ ਜਿਹੜਾ ਪੜ੍ਹਾਉਣ ਦਾ ਤਰੀਕਾ ਅੱਗੇ ਨਾਲੋਂ ਚੰਗਾ ਹੈ ਔਰ ਉਪਕਰਨ ਜਿਹੜੇ ਆ ਸਕੂਲਾਂ ਦੇ ਵਿੱਚ ਅੱਗੇ ਨਾਲੋਂ ਕਾਫੀ ਕੰਪਿਊਟਰ ਵਗੈਰਾ ਲੈਬਾਂ ਜਿਹੜੇ ਆ ਉਹ ਚੰਗੀਆਂ ਹੈਗੀਆਂ ਨੇ ਬਾਕੀ ਇਹ ਸਮਾਜ ਭਲਾਈ ਦੀਆਂ ਸਕੀਮਾਂ ਜਿਹੜੀਆਂ ਚੱਲ ਰਹੀਆਂ ਜਿਵੇਂ ਕਿ ਬੇ ਬੇਟੀਆਂ ਨੂੰ ਲੜਕੀਆਂ ਨੂੰ ਪੜ੍ਹਾਉਣ ਦੇ ਵਾਸਤੇ ਲੜਕੀਆਂ ਨੂੰ ਪੜ੍ਹਾਉਣ ਲਈ ਇੱਕ ਸਕੀਮ ਤਾਂ ਚਲਾਈ ਗਈ ਆ ਉਹ ਵੀ ਕਾਫੀ ਚੰਗੀ ਸਕੀਮ ਹੈ ਔਰ ਕਈ ਖੇਤਰਾਂ ਦੇ ਵਿੱਚ ਜਿਹੜਾ ਇਹ ਕੰਮ ਚੱਲ ਰਿਹਾ ਹੈ ਜਿਵੇਂ ਕਿ ਇੱਕ ਔਰਤਾਂ ਦੇ ਸਫਰ ਦੇ ਬਾਰੇ ਗੱਲ ਕਰੀਏ ਤਾਂ ਔਰਤਾਂ ਨੂੰ ਸਫ਼ਰ ਦੇ ਵਿੱਚ ਆਉਣ ਜਾਣ ਦਾ ਜਿਹੜਾ ਬੱਸ ਦਾ ਕਿਰਾਇਆ ਇਹ ਫਰੀ ਕੀਤਾ ਹੈ ਮੁਆਫ਼ ਕੀਤਾ ਗਿਆ ਹੈ ਮਤਲਬ ਕਿ ਫਰੀ ਸਫ਼ਰ ਹੈ ਯਾਤਰਾ ਦੀ ਜਿਹੜੀ ਸਹੂਲਤ ਹੈ ਦਿੱਤੀ ਗਈ ਹੈ ਜਿਹਦੇ ਨਾਲ ਕਿ ਔਰਤਾਂ ਨੂੰ ਕਾਫੀ ਫਾਇਦਾ ਹੋਇਆ ਅਤੇ ਇਹ ਇੱਕ ਮੁੱਖ ਸਕੀਮ ਹੈਗੀ